ਮੈਨੂੰ ਖੇਡਣ ਦਾ ਬਹੁਤ ਸ਼ੌਂਕ ਸੀ ਖੇਡਦੇ ਖੇਡਦੇ ਸ਼ੌਂਕ ਦੌੜਨ ਦਾ ਬਣ ਗਿਆ ਔਰ ਪਰ ਮੈਨੂੰ ਦੌੜਨ ਲਈ ਪ੍ਰੇਰਿਤ ਸਕੂਲ ਦੇ ਵਿੱਚ ਮੇਰੇ ਅਧਿਆਪਕਾਂ ਨੇ ਕੀਤਾ ਜਿੱਦਾਂ ਕਿ ਸਕੂਲ ਦੇ ਵਿੱਚ ਅੱਧੀ ਛੁੱਟੀ ਵੇਲੇ ਬੱਚੇ ਖੇਲਦੇ ਹੈ ਔਰ ਟੀਚਰ ਦੇਖਦੇ ਹੈ ਕਿ ਇਹ ਬੱਚਾ ਤੇਜ ਭੱਜ ਰਿਹਾ ਜਾਂ ਇਹ ਹੌਲੀ ਭੱਜ ਰਿਹਾ ਜਿਵੇਂ ਸਾਡੇ ਸਰੀਰਕ ਸਿੱਖਿਆ ਦੇ ਅਧਿਆਪਕ ਸੀ ਉਹਨਾਂ ਨੇ ਮੈਨੂੰ ਦੇਖਿਆ ਹੋਊਗਾ ਔਰ ਸਕੂਲ ਦੇ ਵਿੱਚ ਜਦੋਂ ਖੇਡਾਂ ਦੇ ਕੰਪੀਟੀਸ਼ਨ ਹੁੰਦੇ ਤਾਂ ਉਹਨਾਂ ਨੇ ਮੇਰਾ ਨਾਮ ਲਿਆ ਕਿ ਤੁਸੀਂ ਬਹੁਤ ਵਧੀਆ ਦੌੜਦੇ ਹੋ ਤੁਸੀਂ ਰੇਸਾਂ ਦੇ ਵਿੱਚ ਲੱਗੋ ਤਾਂ ਅਸਲ ਦੇ ਵਿੱਚ ਮੇਰੇ ਅਧਿਆਪਕ ਨੇ ਹੀ ਮੈਨੂੰ ਦੌੜਨ ਲਈ ਪ੍ਰੇਰਿਤ ਕੀਤਾ ਸਾਡੇ ਸਕੂਲ ਦੇ ਵਿੱਚ ਕੰਪੀਟੀਸ਼ਨ ਹੁੰਦੇ ਰਹਿੰਦੇ ਸੀ ਔਰ ਮੈਨੂੰ ਉਹ ਹਰ ਵਾਰ ਦੌੜਾਂ ਦੇ ਵਿੱਚ ਹੀ ਲਾਉਂਦੇ ਮੈਂ ਸੌ ਮੀਟਰ ਦੀ ਦੌੜ ਵੀ ਭੱਜੀ ਹੋਈ ਹਾਂ ਮੈਂ ਦੋ ਸੌ ਮੀਟਰ ਦੀ ਦੌੜ ਵੀ ਭੱਜੀ ਹੋਈ ਹੈ ਔਰ ਮੈਂ ਚਾਰ ਸੋ ਮੀਟਰ ਦੀ ਦੌੜ ਵੀ ਭੱਜੀ ਹੋਈ ਹੈ ਅਤੇ ਮੈਂ ਅੱਠ ਸੋ ਮੀਟਰ ਦੀ ਦੌੜ ਵੀ ਭੱਜੀ ਹੋਈ ਹੈ ਔਰ ਭਰਵਾ ਭਗਵਾਨ ਦੀ ਕਿਰਪਾ ਦੇ ਨਾਲ ਮੇਰੀਆਂ ਸਾਰੀਆਂ ਦੌੜਾਂ ਦੇ ਵਿੱਚੋਂ ਪਹਿਲਾਂ ਨੰਬਰ ਆਉਂਦਾ ਰਿਹਾ ਮੈਂ ਆਪਣੀਆਂ ਦੌੜਾਂ ਮੇਰੇ ਖਿਆਲ ਦੇ ਵਿੱਚ ਪੰਜਵੀਂ ਕਲਾਸ ਤੋਂ ਸ਼ੁਰੂ ਕੀਤੀਆਂ ਅਤੇ ਇਹ ਦਸਵੀਂ ਤੱਕ ਚੱਲਦੀਆਂ ਰਹੀਆਂ ਔਰ ਸਕੂਲ ਦੇ ਵਿੱਚ ਸਾਡੇ ਕੈਂਪ ਲੱਗਦੇ ਸੀ ਅਲੱਗ ਅਲੱਗ ਸ਼ਹਿਰਾਂ ਦੇ ਵਿੱਚ ਤਾਂ ਮੇਰੇ ਅਧਿਆਪਕ ਮੈਨੂੰ ਦੌੜਾਂ ਲਈ ਹਰ ਥਾਂ 'ਤੇ ਲੈ ਕੇ ਜਾਂਦੇ ਸੀ ਅਤੇ ਜਿਵੇਂ ਕਿ ਮੈਂ ਬਹੁਤ ਦੌੜਾਂ ਦੇ ਵਿੱਚ ਭਾਗ ਲਿਆ ਪਰ ਸਮੇਂ ਦੇ ਨਾਲ ਨਾਲ ਦੌੜਾਂ ਦੇ ਵਿੱਚ ਰੁਚੀ ਵਧਦੀ ਗਈ ਵਧਦੀ ਗਈ ਵਧਦੀ ਗਈ ਤਾਂ ਅਧਿਆਪਕਾਂ ਨੂੰ ਵੀ ਲੱਗਿਆ ਕਿ ਤੈਨੂੰ ਦੌੜਨਾ ਚਾਹੀਦਾ